ਪੰਜਾਬੀ ਭਾਸ਼ਾ ਅਤੇ ਬੰਗਾਲੀ ਦੋਹਾਂ ਭਾਸ਼ਾਵਾਂ ਦੀ ਇੱਕ ਮੁੱਖ ਵਿਭਿੰਨਤਾ ਹੈ ਜੋ ਉਤਪੰਨ ਪੱਧਰ 'ਤੇ ਸੀਮਿਤ ਨਹੀਂ ਹੈ ਦੋਹਾਂ ਭਾਸ਼ਾਵਾਂ ਦਾ ਇੱਕ ਸਾਹਿਤਕ ਇਤਿਹਾਸ ਹੈ ਅਤੇ ਦੋਹਾਂ ਵਿੱਚ ਲੋਕਾਂ ਦੀ ਬੜੀ ਸੰਖਿਆ ਵਿੱਚ ਵਰਤੇ ਜਾਂਦੇ ਹਨ ਦੋਹਾਂ ਦੀਆਂ ਭਾਸ਼ਾਵਾਂ ਵਿੱਚ ਸਾਂਝੀ ਅੰਕੜਾ ਸੰਗੀਤ ਰੰਗਾਂ ਆਦਿ ਨੂੰ ਲੈ ਕੇ ਵੀ ਸੰਬੰਧ ਹਨ ਸਾਹਿਤਕ ਕਾਰੇ ਕਾਰਵਾਈ ਦੀ ਇੱਕ ਵਜੇ ਤੋਂ ਇਹ ਦੋਹਾਂ ਭਾਸ਼ਾਵਾਂ ਦਾ ਸਾਂਝਾ ਸੰਬੰਧ ਹੈ ਇਹ ਹਰ ਸਮੇਂ ਲਈ ਇੱਕ ਸਬੰਧੀ ਅਤੇ ਮਹੱਤਵਪੂਰਨ ਸੰਬੰਧ ਦਰਜਾ ਕਰਦੇ ਹਨ ਇਸ ਤੌਰ 'ਤੇ ਪੰਜਾਬੀ ਅਤੇ ਬੰਗਾਲੀ ਭਾਸ਼ਾਵਾਂ ਵਿੱਚ ਇੱਕ ਗਹਿਰਾ ਔਰ ਸਥਾਈ ਸੰਬੰਧ ਹੈ